ਜਿਵੇਂ ਕਿ ਮੇਰੀ ਮਾਂ ਬੋਲੀ ਪੰਜਾਬੀ ਹੈ ਅਤੇ ਮੈਨੂੰ ਹਰ ਕੰਮ ਹਰ ਚੀਜ਼ 'ਚ ਪੰਜਾਬੀ ਦੇ ਵਿੱਚ ਕਰਨ ਦੇ ਵਿੱਚ ਹੀ ਵਧੀਆ ਲੱਗਦਾ ਹੈ ਕਿਉਂਕਿ ਮੈਂ ਉਹਦੇ ਨਾਲ ਆਪਣੀ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਸ਼ੇਅਰ ਕਰ ਪਾਉਂਦੀ ਹਾਂ ਤਾਂ ਉਹਦੇ ਨਾਲ ਮੈਂ ਈਜ਼ਲੀ ਸਮਝਾ ਸਕਦੀ ਆ ਦੂਜੇ ਬੰਦੇ ਨੂੰ ਨਾ ਦੂਜੀ ਇਹ ਗੱਲ ਹੈ ਕਿ ਜਿਹੜੀ ਮੈਨੂੰ ਮੈਂ ਮੈਨੂੰ ਲੋਕ ਜਿਹੜੇ ਗਾਇਨ ਹੈ ਲੋਕ ਗੀਤ ਆ ਉਹ ਮੈਨੂੰ ਬਹੁਤ ਪਸੰਦ ਹੈ ਮੈਨੂੰ ਆਪ ਵੀ ਗਾਉਣ ਦਾ ਬਹੁਤ ਸ਼ੌਂਕ ਹੈ ਅਤੇ ਮੈਂ ਉਹਦੇ ਲਈ ਨਾ ਜਿਹੜਾ ਵੀ ਕੰਸੈਪਟ ਹੁੰਦਾ ਉਹਨੂੰ ਮੈਂ ਨਾ ਪੰਜਾਬੀ ਦੇ ਵਿੱਚ ਹੀ ਲਿਖਣਾ ਪਸੰਦ ਕਰਦੀ ਹਾਂ ਮੈਂ ਇੱਕ ਬੁੱਕ ਲਗਾ ਰੱਖੀ ਹੈ ਜਿਹਦੇ ਵਿੱਚ ਮੈਂ ਬਹੁਤ ਸਾਰੇ ਲੋਕ ਗੀਤ ਲਿਖੇ ਹੋਏ ਹੈ ਅਤੇ ਜਦੋਂ ਵੀ ਕੋਈ ਫੰਕਸ਼ਨ ਆਉਂਦਾ ਹੈ ਜਿੱਦਾਂ ਲੋਹੜੀ ਹੋ ਗਈ ਵਿਸਾਖੀ ਹੋ ਗਈ ਤਾਂ ਮੈਂ ਉਹਦੇ ਵਿੱਚ ਉਹੀ ਜਿਹੜੀ ਹੈ ਬੁੱਕ ਕਿਤਾਬ ਹੈਗੀ ਹੈ ਮੈਂ ਲੈ ਕੇ ਜਾਂਦੀ ਹਾਂ ਅਤੇ ਉਹਦੇ ਵਿੱਚ ਜਿੰਨੇ ਵੀ ਲੋਕ ਗੀਤ ਹੁੰਦੇ ਆ ਅਤੇ ਮੈਂ ਉਨ੍ਹਾਂ ਵਿੱਚੋਂ ਸਿਲੈਕਟ ਕਰਕੇ ਉਹ ਲੋਕ ਗੀਤ ਗਾਉਂਦੀ ਹਾਂ